ਕੁਝ ਮਹਾਨ ਆਗੂ ਜਿਨ੍ਹਾਂ ਬਾਰੇ ਮੈਂ ਆਪਣੇ ਪਿਤਾ ਜਾਂ ਦਾਦਾ ਜੀ ਤੋਂ ਸੁਣਿਆ ਹੈ ਉਹਨਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਸਨ ਜਿਹਨਾਂ ਨੇ ਅਫ਼ਗਾਨੀਸਥਾਨ ਤੋਂ ਲੈ ਕੇ ਬਹੁਤ ਦੂਰ ਤੱਕ ਰਾਜ ਕੀਤਾ ਹੈ ਅਤੇ ਜਿਹਨਾਂ ਦਾ ਸਾਡੇ ਖੇਤਰ ਜਿਵੇਂ ਰੋਪੜ ਦੇ ਵਿੱਚ ਵੀ ਸੰਧੀ ਹੋਈ ਸੀ ਇੱਥੇ ਵੀ ਯੋਗਦਾਨ ਹੈ ਸੋ ਮੈਂ ਇੰਨਾ ਹੀ ਜਾਣਦਾ ਹਾਂ